ਸਾਡੇ ਸ਼ਹਿਰ ਦਾ ਨਾਮ ਕੁਰਾਲੀ ਹੈ ਇਹ ਆਪਣੀ ਭੂਗੋਲਿਕ ਸਥਿਤੀ ਕਾਰਨ ਬਹੁਤ ਹੀ ਖਾਸ ਸ਼ਹਿਰ ਹੈ ਇੱਥੋਂ ਦੀ ਸਭ ਤੋਂ ਵਧੀਆ ਚੀਜ਼ ਇਹ ਹੈ ਕਿ ਇੱਥੇ ਸਾਰੀਆਂ ਸਹੂਲਤਾਂ ਬਹੁਤ ਹੀ ਨੇੜੇ ਨੇੜੇ ਹਨ ਤੁਹਾਨੂੰ ਇੱਕ ਡੇਢ ਕਿਲੋਮੀਟਰ ਦੇ ਨੇ ਦਾਇਰੇ ਵਿੱਚ ਹਸਪਤਾਲ ਸਰਕਾਰੀ ਸੰਸਥਾਵਾਂ ਪ੍ਰਸ਼ਾਸਨਿਕ ਸਰਕਾਰੀ ਦਫ਼ਤਰ ਸਿੱਖਿਅਕ ਸੰਸਥਾਵਾਂ ਮੁਹੱਈਆ ਹਨ ਇੱਥੇ ਕਈ ਵੱਡੇ ਵੱਡੇ ਕੋਲਜ ਹਨ ਇੱਥੇ ਨਰਸਿੰਗ ਕੋਲਜ ਵੀ ਹੈ ਇੱਥੇ ਵੈਟਨਰੀ ਕੁੱਤਿਆਂ ਦਾ ਜਾਨਵਰਾਂ ਦਾ ਹਸਪਤਾਲ ਵੀ ਹੈ ਇਸ ਲਈ ਇਹ ਇੱਕ ਛੋਟੇ ਸ਼ਹਿਰ ਦੇ ਹੋਣ ਨਾਲ਼ ਆਪਣਾ ਸਾਰੇ ਪ੍ਰਬੰਧ ਇੱਥੇ ਵਧੀਆ ਸਥਾਪਿਤ ਹਨ ਇੱਥੇ ਖਾਣ ਪੀਣ ਦੀਆਂ ਵੀ ਬਹੁਤ ਜ਼ਿਆਦਾ ਚੀਜ਼ਾਂ ਮੁਹੱਈਆ ਹਨ ਜਿਹਨਾਂ ਵਿੱਚੋਂ ਇੱਥੇ ਲੋਕ ਔਰਗੈਨਿਕ ਖੇਤੀ ਕਰਦੇ ਹਨ ਜੋ ਕਿ ਆਪਣੇ ਆਪ 'ਚ ਇੱਕ ਖਾਸ ਚੀਜ਼ ਹੈ ਲੋਕ ਬਹੁਤ ਦੂਰੋਂ ਦੂਰੋਂ ਆ ਕੇ ਇੱਥੇ ਰਹਿੰਦੇ ਹਨ ਅਤੇ ਇਸ ਸੱਭਿਆਚਾਰਕ ਭਿੰਨ ਵਿਭਿੰਨਤਾਵਾਂ ਹੋਣ ਕਾਰਨ ਵੀ ਇੱਥੇ ਲੋਕਾਂ 'ਚ ਏਕਤਾ ਹੈ ਅਤੇ ਇਹ ਚੀਜ਼ ਸਾਨੂੰ ਬਹੁਤ ਮਨ ਭਾਉਂਦੀ ਹੈ